ਜਦੋਂ ਮੈਂ ਲਿਖਤੀ ਪ੍ਰਕਿਰਿਆ ਦੇ ਵਿੱਚ ਆਇਆ ਤਾਂ ਮੇਰਾ ਪਹਿਲਾਂ ਕੰਮ ਇਹ ਹੁੰਦਾ ਸੀ ਕਿ ਮੈਂ ਡਾਇਰੀ ਦੇ ਵਿੱਚ ਦਰਜ ਕਰ ਲਵਾਂ ਪਰੰਤੂ ਸਮਾਂ ਪੈਣ ਦੇ ਨਾਲ ਮੇਰੀ ਤਰਜੀਹ ਮੋਬਾਈਲ ਵੱਲ ਹੋ ਗਈ ਮੋਬਾਈਲ ਦੇ ਵਿੱਚ ਡਿਜ਼ੀਟਲ ਡਾਇਰੀ ਮਿਲ ਜਾਂਦੀ ਸੀ ਉਸ ਦੇ ਵਿੱਚ ਮੈਂ ਆਪਣੀਆਂ ਲਿਖਤਾਂ ਨੂੰ ਸ਼ਾਮਿਲ ਕਰਨ ਲੱਗ ਪਿਆ ਕਿਉਂਕਿ ਇੱਕ ਤਾਂ ਡਾਇਰੀਆਂ ਨੂੰ ਨਾਲ ਲੈ ਕੇ ਚੱਲਣਾ ਮੁਸ਼ਕਿਲ ਹੋ ਜਾਂਦਾ ਸੀ ਅਤੇ ਇਹਨਾਂ ਨੂੰ ਸੰਭਾਲਣਾ ਵੀ ਔਖਾ ਸੀ ਪਰੰਤੂ ਜਦੋਂ ਡਿਜ਼ੀਟਲ ਦੌਰ ਆਇਆ ਤਾਂ ਮੈਂ ਆਪਣੀਆਂ ਸਾਰੀਆਂ ਲਿਖਤਾਂ ਨੂੰ ਮੋਬਾਈਲ ਦੇ ਵਿੱਚ ਦਰਜ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਨਾਲ ਜੇਕਰ ਮੇਰਾ ਕਿਤੇ ਮੋਬਾਈਲ ਵੀ ਗੁੰਮ ਹੋ ਜਾਂਦਾ ਹੈ ਤਾਂ ਇਹਨਾਂ ਲਿਖਤਾਂ ਦਾ ਬੈਕਅੱਪ ਵੀ ਮੈਂ ਦੂਜੇ ਮੋਬਾਇਲ ਦੇ ਵਿੱਚ ਸਾਂਭ ਕੇ ਰੱਖ ਸਕਦਾ ਹਾਂ ਇਸ ਤੋਂ ਇਲਾਵਾ ਜਿਹੜੀ ਮੇਰੀ ਲਿਖਤੀ ਪ੍ਰਕਿਰਿਆ ਹੈ ਉਸ ਦੇ ਵਿੱਚ ਮੈਂ ਕੀ ਕਰਦਾ ਹਾਂ ਕਿ ਲਿਖਤਾਂ ਨੂੰ ਸਾਂਭ ਕੇ ਫੋਲਡਰਾਂ ਦੇ ਵਿੱਚ ਰੂਪਾਂਤਰਿਤ ਕਰ ਦਿੰਦਾ ਹਾਂ ਅਤੇ ਉਹਦੇ ਵਿੱਚ ਲੱਖ ਅਲੱਗ ਵਿਧਾਵਾਂ ਨੇ ਅਤੇ ਉਸ ਵਿਧਾਵਾਂ ਦੇ ਅਨੁਸਾਰ ਮੈਂ ਗਜ਼ਲ ਗੀਤ ਕਾਵਿ ਰੂਪ ਦੋਹੇ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਹਾਂ